ਭੰਗੜੇ ਦੇ ਪ੍ਰਦਰਸ਼ਨ ਲਈ ਸਭ ਤੋਂ ਜਿਆਦਾ ਚਮਕੀਲੇ ਅਤੇ ਵੱਖ ਵੱਖ ਰੰਗਾਂ ਦੇ ਪਹਿਨਾਵੇ ਦੀ ਜਰੂਰਤ ਹੁੰਦੀ ਹੈ ਜਿਸ ਵਿੱਚ ਪੰਜਾਬੀ ਕੁੜਤਾ ਚਾਦਰਾਂ ਫੁੱਲਾਂ ਵਾਲੇ ਡਿਜਾਇਨ ਵਾਲੀ ਜੈਕਟ ਗਲੇ ਵਿੱਚ ਕੰਠਾ ਜਾਂ ਮੋਤੀਆਂ ਵਾਲਾ ਹਾਰ ਹੁੰਦਾ ਹੈ ਇਸ ਤੋਂ ਇਲਾਵਾ ਸਿਰ ਉੱਪਰ ਰੰਗਦਾਰ ਪਗੜੀ ਦਾ ਹੋਣਾ ਬਹੁਤ ਜਰੂਰੀ ਹੁੰਦਾ ਹੈ ਭੰਗੜੇ ਲਈ ਪੱਗ ਵੀ ਵਿਸ਼ੇਸ਼ ਤਰ੍ਹਾਂ ਨਾਲ ਸਜਾਈ ਜਾਂਦੀ ਹੈ ਜਿਸ ਉੱਪਰ ਇੱਕ ਤੁਰਲਾ ਹੁੰਦਾ ਹੈ ਜੋ ਗਰਦਨ ਦੇ ਪਿੱਛੇ ਲਟਕਦਾ ਹੁੰਦਾ ਹੈ ਅਤੇ ਉੱਪਰ ਇੱਕ ਫਰਲਾ ਹੁੰਦਾ ਹੈ ਜੋ ਇੱਕ ਵਿਸ਼ੇਸ਼ ਪ੍ਰਕਾਰ ਦੇ ਕੱਪੜੇ ਨੂੰ ਮਾਵਾ ਲਗਾ ਕੇ ਤਿਆਰ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਪੱਗ ਉੱਪਰ ਇੱਕ ਰੰਗਦਾਰ ਪੱਟੀ ਬੰਨੀ ਜਾਂਦੀ ਹੈ ਭੰਗੜੇ ਦੀ ਟੀਮ ਦੇ ਹਰ ਇੱਕ ਮੈਂਬਰ ਨੂੰ ਅਲੱਗ ਅਲੱਗ ਦੀ ਪੋਸ਼ਾਕ ਪਾਈ ਜਾਂਦੀ ਹੈ ਜੋ ਇੱਕ ਰੰਗ ਬਿਰੰਗੀ ਫੁਲਵਾੜੀ ਦੀ ਤਰਾਂ ਲੱਗਦੀ ਹੈ ਇਸ ਤੋਂ ਇਲਾਵਾ ਪਿੱਤਲ ਦੇ ਕੋਕਿਆਂ ਵਾਲਾ ਖੁੰਡਾ ਅਤੇ ਤਿੱਲੇ ਵਾਲੀ ਜੁੱਤੀ ਭੰਗੜੇ ਵਿੱਚ ਚਾਰ ਚੰਦ ਲਾਉਂਦੀ ਹੈ ਭੰਗੜੇ ਵਿੱਚ ਗੋਟੇ ਅਤੇ ਕਨਾਰੀਆਂ ਵਾਲੇ ਕੱਪੜੇ ਸੁੰਦਰ ਅਤੇ ਰੰਗ ਵਰਾ ਕੱਪੜੇ ਭੰਗੜੇ ਦੀ ਸ਼ੋਭਾ ਨੂੰ ਵਧਾਉਂਦੇ ਹਨ